ਹੈਲੋ ਹਾਂਜੀ ਹਾਂਜੀ ਸੰਦੀਪ ਕੌਰ ਬੋਲਦੀ ਪਈ ਹਾਂ ਦੱਸੋ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਦੱਸੋ ਹਾਂਜੀ ਹਾਂਜੀ ਮੈਮ ਇੱਥੇ ਕੈਫ਼ੀ ਟੈਲੀਆ ਹੈਗਾ ਹੈ ਤਾਜ ਰੈਸਟੋਰੈਂਟ ਹੈਗਾ ਹੈ ਇੱਕ ਆਪਣਾ ਚੁੱਲ੍ਹਾ ਹੈਗਾ ਹੈ ਅਤੇ ਇੱਥੇ ਇਹ ਕਿ ਫੈਮਲੀ ਅਸੀਂ ਸਾਰੇ ਫੈਮਲੀ ਮੈਂਬਰ ਬੈਠ ਕੇ ਆਰਾਮ ਨਾਲ ਖਾ ਸਕਦੇ ਹਾਂ ਇੱਥੇ ਫੈਸਿਲਿਟੀਜ਼ ਬਹੁਤ ਵਧੀਆ ਵਾ ਬਾਕੀ ਬੈਠਣ ਦਾ ਪ੍ਰਬੰਧ ਵੀ ਬਹੁਤ ਵਧੀਆ ਹੈ ਔਰ ਇੱਥੇ ਸਾਫ਼ ਸਫ਼ਾਈ ਵੀ ਕਾਫੀ ਆ ਖਾਣ ਪੀਣ ਦਾ ਜੋ ਸਮਾਨ ਵੀ ਆ ਨਾ ਉਹਦੇ ਵਿੱਚ ਵੀ ਸਫ਼ਾਈ ਰੱਖੀ ਜਾਂਦੀ ਹੈ ਬਾਕੀ ਇੱਥੇ ਲੱਗੇ ਹੋਏ ਏਸੀ ਵਗੈਰਾ ਲੱਗੇ ਹੋਏ ਆ ਕੋਈ ਬੈਠਣ ਦੀ ਕੋਈ ਇਸ਼ੂ ਨਹੀਂ ਹੈਗਾ ਅਤੇ ਖਾਣ ਦੇ ਵਿੱਚ ਸਾਨੂੰ ਆਰਾਮ ਨਾਲ ਡਿਸ਼ਿਜ਼ ਜਿਹੜੀਆਂ ਵਾਂ ਬੜੀਆਂ ਸਵਾਦਿਸ਼ਟ ਮਿਲਦੀਆਂ ਵਾਂ ਅਤੇ ਮਿੱਠਾ ਵੀ ਖਾ ਸਕਦੇ ਹੋ ਨਮਕੀਨ ਸਾਰਾ ਵਧੀਆ ਮਿਲਦਾ ਹੈ ਬਾਕੀ ਇਹ ਆ ਕਿ ਤੁਸੀਂ ਜੇ ਵੈੱਜ ਖਾਣਾ ਚਾਹੁੰਦੇ ਹੋ ਵੈੱਜ ਵੀ ਮਿਲੇਗਾ ਨੋਨ ਵੈੱਜ ਖਾਣਾ ਚਾਹੁੰਦੇ ਉਹ ਵੀ ਮਿਲ ਜਾਏਗਾ ਹਾਂਜੀ ਸਾਰੀ ਇੱਥੇ ਫੈਸਿਲਿਟੀਜ਼ ਹੈਗੀਆਂ ਵਾਂ ਤੁਸੀਂ ਇੱਥੇ ਵਿਜ਼ਿਟ ਕਰੋਗੇ ਤਾਂ ਤੁਹਾਨੂੰ ਸਾਰਾ ਪਤਾ ਲੱਗ ਜਾਏਗਾ ਕੋਈ ਗੱਲ ਨਹੀਂ ਤੁਸੀਂ ਆਓ ਤੁਹਾਡਾ ਜਦੋਂ ਤੁਸੀਂ ਆਓਗੇ ਅਤੇ ਅਸੀਂ ਤੁਹਾਡੀ ਪੂਰੀ ਹੈਲਪ ਕਰਾਂਗੇ ਕੋਈ ਗੱਲ ਨਹੀਂ ਓਕੇ ਜੀ ਥੈਂਕ ਯੂ